ਸਾਡੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਬੱਸਾਂ ਪ੍ਰਾਈਵੇਟ ਸਰਕਾਰੀ ਜਿਹੜੀਆਂ ਕਿ ਲੌਂਗ ਵੱਡੇ ਰੂਟ ਦੀਆਂ ਬੱਸਾਂ ਕਿਤੇ ਦੂਰ ਜਾਣ ਵਾਸਤੇ ਲੋਕਲ ਚੱਲਣ ਵਾਸਤੇ ਹਰ ਪ੍ਰਕਾਰ ਦੀਆਂ ਬੱਸਾਂ ਉਪਲੱਬਧ ਹੈ ਇੱਥੇ ਨਾਲ ਸਾਨੂੰ ਆਟੋ ਵੀ ਉਪਲੱਬਧ ਹੈ ਅਤੇ ਇਹਦੇ ਨਾਲ ਰਹਿਣ ਨਾਲ ਸਾਨੂੰ ਮਤਲਬ ਜਿਵੇਂ ਅਸੀਂ ਕਿਤੇ ਕਿਸੇ ਰਿਸ਼ਤੇਦਾਰ ਕੋਲ ਜਾਣਾ ਹੈ ਘਰ 'ਚੋਂ ਨਿਕਲਣ ਵਾਸਤੇ ਆਟੋ ਵੀ ਜ਼ਰੂਰੀ ਆਟੋ ਫੜ ਲਈ ਦਾ ਹੈ ਅਤੇ ਉਸ ਤੋਂ ਬਾਅਦ 'ਚ ਅੱਗੇ ਉਹ ਬੱਸ ਤੱਕ ਪਹੁੰਚਾ ਦਿੰਦੇ ਹੈ ਬੱਸ ਅੱਗੇ ਸਾਨੂੰ ਅੱਗੇ ਸਾਡੇ ਟਾਰਗੇਟ 'ਤੇ ਪਹੁੰਚਾ ਦਿੰਦੀ ਰਿਸ਼ਤੇਦਾਰਾਂ ਕੋਲ ਪਹੁੰਚਾ ਦਿੰਦੀ ਹੈ ਜਿੱਥੇ ਅਸੀਂ ਪਹੁੰਚਣਾ ਹੁੰਦਾ ਅਸੀਂ ਨੌਕਰੀ 'ਤੇ ਜਾਣਾ ਅਤੇ ਸਾਡੇ ਸਮੇਂ ਸਮੇਂ ਸਿਰ ਇਹ ਮਿਲਦੀਆਂ ਰਹਿੰਦੀਆਂ ਅਸੀਂ ਸਮੇਂ ਸਮੇਂ ਸਿਰ 'ਤੇ ਜਾਂਦੇ ਰਹਿੰਦੇ ਹਾਂ ਅਤੇ ਹਰ ਇੱਕ ਚੀਜ਼ ਜਿਵੇਂ ਕੋਈ ਚੀਜ਼ ਪਹੁੰਚਣਾ ਅਸੀਂ ਕਿਸੇ ਜਗ੍ਹਾ 'ਤੇ ਵਧੀਆ ਤਰੀਕੇ ਨਾਲ ਪਹੁੰਚ ਜਾਂਦੇ ਹਾਂ ਅਤੇ ਪਰ ਤੇਜ਼ੀ ਨਾਲ ਸਾਨੂੰ ਇਹ ਪਹੁੰਚਾ ਦਿੰਦੇ ਆ ਅਤੇ ਇਹਦਾ ਸਾਨੂੰ ਯਾਨੀ ਕੇ ਬਹੁਤ ਫਾਇਦਾ ਹੁੰਦਾ ਅਤੇ ਸ ਜਿਹੜਾ ਸਾਡੀ ਏਜ ਮਤਲਬ ਆਉਣ ਜਾਣ ਵਿੱਚ ਸਾਡੇ ਸੁਖਾਲਾ ਕਰਦੇ ਜਿਹੜੀਆਂ ਵਾ